ਯਾਰ ਹਾਂ ਅੰਕਿਤ ਯਾਰ ਗਿਆ ਕਿੱਧਰ ਰਹਿ ਗਿਆ ਆਇਆ ਨਹੀਂ ਤੂੰ ਹਜੇ ਯਾਰ ਕਿੱਥੇ ਕੁ ਟਰੈਫਿਕ ਹੈਗਾ ਅੱਜ ਤਾਂ ਵੈਸੇ ਕੋਈ ਇੱਦਾਂ ਹੈ ਨਹੀਂ ਸੀਗਾ ਡੀ ਸੀ ਚੌਂਕ ਓਕੇ ਹੋ ਸਕਦਾ ਅੱਜ ਕੱਲ੍ਹ ਕਾਫੀ ਜ਼ਿਆਦਾ ਚੱਲ ਰਿਹੇ ਨੇ ਚਲਾਨ ਵਗੈਰਾ ਵੀ ਕੱਟ ਰਹੇ ਨੇ ਉਹਦੇ ਕਾਰਨ ਵੀ ਉੱਥੇ ਜਾਮ ਲੱਗ ਜਾਂਦਾ ਵਾ ਕੁਛ ਲਾਈਟਾਂ ਕਾਰਨ ਵੀ ਜਾਮ ਲੱਗ ਜਾਂਦਾ ਵਾ ਹਾਂ ਅਤੇ ਹੁਣ ਤੂੰ ਉੱਥੇ ਡੀ ਸੀ ਚੌਂਕ ਦੇ ਕੋਲ ਹੀ ਖੜ੍ਹਾ ਉੱਥੇ ਜਾਂ ਹੋਰ ਕਿਤੋਂ ਓ ਹੋ ਯਾਰ ਅਸੀਂ ਤਾਂ ਜਾਣਾ ਸੀਗਾ ਬਹੁਤ ਹੁਣ ਨਿਕਲਣਾ ਸੀਗਾ ਅੱਗੇ ਦੇਖ ਲਾ ਜੇ ਇੱਧਰ ਜਿਹੜਾ ਹੈਗਾ ਵਾ ਮੋਡਲ ਟਾਊਨ ਵੱਲੋ ਨਹੀਂ ਤਾਂ ਉੱਥੋ ਵਾਪਸ ਨਿਕਲ ਕੇ ਆ ਜਾ ਦੂਜਾ ਰੂਟ ਲੈ ਲੈ ਅੱਛਾ

ਅੱਛਾ ਜੀ ਚਲੋ ਠੀਕ ਹੈ ਦੇਖ ਲਈਂ ਫਿਰ ਜਿੱਦਾਂ ਜੇ ਜੇ ਕਿਤੇ ਡਾਈਵਰਸ਼ਨ ਮਿਲਦੀ ਹੈ ਕਿਤੋਂ ਹੋਰ ਰੂਟ ਫੜ ਕੇ ਦੂਜੇ ਪਾਸੋਂ ਫਿਰ ਮੇਰੇ ਕੋਲ ਆ ਜੀਂ ਫੇਰ ਚੱਲ ਠੀਕ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਓਕੇ